ਪੰਜਾਬ ਵਿੱਚ ਖੇਤੀਬਾੜੀ ਸੈਕਟਰ ਨਵੀਨਤਾ ਨੂੰ ਬਹੁਤ ਅਲੱਗ ਅਲੱਗ ਤਰੀਕਿਆਂ ਨਾਲ ਉਤਸ਼ਾਹਿਤ ਕਰਦਾ ਹੈ ਚਾਹੇ ਉਹ ਖੋਜ ਦਾ ਕੇਂਦਰ ਹੋਵੇ ਚਾਹੇ ਉਹ ਵਿਕਾਸ ਦਾ ਕੇਂਦਰ ਹੋਵੇ ਖੋਜ ਵਾਲੇ ਪਾਸੋਂ ਜਾਂ ਵਿਕਾਸ ਵਾਲੇ ਪਾਸੋਂ ਨਵੇਂ ਨਵੇਂ ਤਰ੍ਹਾਂ ਦੀ ਮਸ਼ੀਨਰੀ ਆ ਰਹੀ ਹੈ ਜਿਸ ਦੇ ਨਾਲ ਖੇਤੀ ਕਰਨੀ ਬਹੁਤ ਆਸਾਨ ਹੋ ਰਹੀ ਹੈ ਜਿਵੇਂ ਕਿ ਕਣਕ ਵੱਢਣ ਵਾਲੀ ਮਸ਼ੀਨ ਤੂੜੀ ਬਣਾਉਣ ਵਾਲੀ ਮਸ਼ੀਨ ਮੱਕੀ ਬੀਜਣ ਵਾਲੀ ਮਸ਼ੀਨ ਅਲੱਗ ਅਲੱਗ ਤਰ੍ਹਾਂ ਦੇ ਨਵੀਂ ਮਸ਼ੀਨਰੀ ਆ ਰਹੀ ਹੈ ਜਿਸ ਦੇ ਨਾਲ ਖੇਤੀ ਕਰਨੀ ਬਹੁਤ ਸੌਖੀ ਹੋ ਰਹੀ ਹੈ ਉਸੇ ਤਰ੍ਹਾਂ ਕਈ ਤਰ੍ਹਾਂ ਦੇ ਨਵੇਂ ਬੀਜ ਆ ਰਹੇ ਹਨ ਜਿਹਨਾਂ ਦੇ ਨਾਲ ਨਰਮਾ ਆਪਾਂ ਜੇਕਰ ਕਹੀਏ ਤਾਂ ਨਰਮੇ ਦੀ ਫਸਲ ਜਾਂ ਪੈਦਾਵਾਰ ਬਹੁਤ ਅੱਛੀ ਹੁੰਦੀ ਹੈ ਜਿਸ ਦੇ ਨਾਲ ਝਾੜ ਵੱਧ ਹੁੰਦਾ ਹੈ ਉਸੇ ਤਰ੍ਹਾਂ ਕਣਕ ਦੇ ਅਲੱਗ ਅਲੱਗ ਤਰ੍ਹਾਂ ਦੇ ਬੀਜ ਆ ਰਹੇ ਹਨ ਜਿਹਨਾਂ ਦੇ ਨਾਲ ਬਹੁਤ ਤਰ੍ਹਾਂ ਦੇ ਆਪਾਂ ਨੂੰ ਫਾਇਦੇ ਹੁੰਦੇ ਹਨ ਜਾਂ ਕਈ ਤਰ੍ਹਾਂ ਦੀਆਂ ਸਬਜ਼ੀਆਂ ਦੇ ਬੀਜ ਇਸ ਤਰ੍ਹਾਂ ਦੇ ਆ ਰਹੇ ਹਨ ਜਿਹਨਾਂ ਦੇ ਨਾਲ ਅਸੀਂ ਅਗੇਤੀ ਫਸਲ ਲੈ ਸਕਦੇ ਹਾਂ